ਮੈਂ ਇੱਕ ਕੰਪਨੀ ਹਾਈ ਪੁਆਇੰਟ ਆਊਟਸੋਰਸਿੰਗ ਦੇ ਵਿੱਚ ਦੋ ਸਾਲ ਕੰਮ ਕੀਤਾ ਉੱਥੇ ਮੇਰਾ ਕੰਮ ਐਜ ਆ ਡਾਟਾ ਐਂਟਰੀ ਓਪਰੇਟਰ ਦਾ ਸੀਗਾ ਪਰ ਉੱਥੇ ਦੇ ਜੋ ਹੈੱਡ ਸੀਗੇ ਉਹ ਬਹੁਤ ਹੀ ਜ਼ਿਆਦਾ ਸਟ੍ਰਿਕਟ ਅਤੇ ਬਹੁਤ ਹੀ ਡਸਿਪਲੀਨ ਪਸੰਦ ਇਨਸਾਨ ਸੀਗੇ ਅਤੇ ਕੋਈ ਵੀ ਇਨਸਾਨ ਕੋਈ ਵੀ ਵਰਕਰ ਉਹਨਾਂ ਨੂੰ ਬਿਨਾਂ ਪਰਮੀਸ਼ਨ ਤੋਂ ਬਿਨਾਂ ਅਪੋਇੰਟਮੈਂਟ ਤੋਂ ਮਿਲ ਨਹੀਂ ਸਕਦਾ ਸੀਗਾ ਪਰ ਮੇਰੀ ਦਿਲ ਦੀ ਇਹ ਮਨਸ਼ਾ ਸੀਗੀ ਕਿ ਮੈਂ ਉਹਨਾਂ ਨੂੰ ਇੱਕ ਵਾਰੀ ਮਿਲਾਂ ਅਤੇ ਇੱਕ ਵਾਰੀ ਉਹਨਾਂ ਕੋਲ ਬੈਠ ਕੇ ਕੰਮ ਕਰਾਂ ਕਿਉਂਕਿ ਉਹ ਐਨੇ ਹੀ ਜ਼ਿਆਦਾ ਹਾਰਡਵਰਕਿੰਗ ਮੈਨ ਸੀਗੇ ਕਿ ਜੋ ਵੀ ਇਨਸਾਨ ਉਹਨਾਂ ਨਾਲ਼ ਕੰਮ ਕਰਦਾ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਲਕਿ ਲੋਕ ਤਾਂ ਇਹ ਵੀ ਕਹਿੰਦੇ ਹੁੰਦੇ ਸਨ ਕਿ ਜਿਨ੍ਹਾਂ ਨੇ ਉਹਨਾਂ ਨਾਲ਼ ਇੱਕ ਵਾਰੀ ਕੰਮ ਕਰ ਲਿਆ ਤਾਂ ਉਹਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਉਹ ਬਹੁਤ ਜ਼ਿਆਦਾ ਹੈਲਪਫੁਲ ਵੀ ਸੀ ਪਰ ਉਹ ਅਸਾਨੀ ਨਾਲ਼ ਕਿਸੇ ਨੂੰ ਨਹੀਂ ਮਿਲਦੇ ਸੀ ਕਿਉਂਕਿ ਉਹ ਐਨਾ ਜ਼ਿਆਦਾ ਬੀਜ਼ੀ ਰਹਿੰਦੇ ਸੀ ਕਿ ਲੋਕ ਉਹਨਾਂ ਨੂੰ ਮਿਲਣੇ ਨੂੰ ਵੀ ਤਰਸਦੇ ਹੁੰਦੇ ਸੀ ਮੈਂ ਸੋਚਦੀ ਰਹਿੰਦੀ ਸੀ ਕਿ ਕਾਸ਼ ਮੇਰਾ ਕਦੀ ਉਹ ਦਿਨ ਆਊਗਾ ਕਿ ਮੈਂ ਵੀ ਉਹਨਾਂ ਨੂੰ ਮਿਲਾ ਮੈਂ ਇਸ ਨੂੰ ਮਿਲ ਉਹਨਾਂ ਨੂੰ ਮਿਲਣ ਲਈ ਬਹੁਤ ਜ਼ਿਆਦਾ ਮਿਹਨਤ ਕਰੀ ਮੈਂ ਰੋਜ਼ ਜ਼ਲਦੀ ਆਫ਼ਿਸ ਵੀ ਜਾਣਾ ਹਾਰਡ ਵਰਕ ਕਰਨਾ ਕੰਮ ਜਲਦੀ ਖ਼ਤਮ ਕਰਨਾ ਕਿ ਉਹ ਮੇਰੀ ਤਾਰੀਫ਼ ਕਰੇ ਵੀ ਹਾਂ ਇਹ ਕਿੰਨੀ ਮਿਹਨਤ ਨਾਲ਼ ਕੰਮ ਕਰਦੀ ਹੈ ਪਰ ਫਿਰ ਵੀ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਫਿਰ ਮੈਂ ਆਪਣੇ ਦਿਲ ਨੂੰ ਤਸੱਲੀ ਦਿੱਤੀ ਕਿ ਕੋਈ ਗੱਲ ਨਹੀਂ ਇੱਕ ਦਿਨ ਐਵੇਂ ਦਾ ਆਵੇਗਾ ਕਿ ਤੂੰ ਉਹਨਾਂ ਨੂੰ ਜ਼ਰੂਰ ਮਿਲੇਗੀ